ਰੋਪੜ ਜ਼ਿਲ੍ਹੇ ਦੇ ਉਦਯੋਗਾਂ ਦੀ ਗੱਲ ਕਰੀਏ ਤਾਂ ਇੱਥੇ ਸਵਰਾਜ ਮਜ਼ਦਾ ਫੈਕਟਰੀ ਹੈ ਅਤੇ ਚੀਮਾਂ ਬੋਆਏਲਰ ਹੈ ਅੰਬੂਜਾ ਸੀਮਿੰਟ ਦੀ ਫੈਕਟਰੀ ਹੈ ਥਰਮਲ ਹੈ ਅਤੇ ਇੱਥੇ ਚੁਣੋਤੀਆਂ ਦੀ ਗੱਲ ਕਰੀਏ ਆਈ ਆਈ ਟੀ ਇੱਕ ਆਈ ਆਈ ਟੀ ਰੋਪੜ ਵੀ ਇੱਥੇ ਹੀ ਆ ਜਿਸ ਵਿੱਚ ਬਹੁਤ ਸਾਰੇ ਆਪਣੇ ਲੋਕਲ ਬੰਦਿਆਂ ਨੂੰ ਕੰਮ ਮਿਲਿਆ ਹੋਇਆ ਹੈ ਅਤੇ ਚੁਣੋਤੀਆਂ ਦੀ ਗੱਲ ਕਰੀਏ ਤਾਂ ਇੱਥੇ ਮੇਨ ਪ੍ਰੋਬਲਮ ਇਹ ਹੈ ਕਿ ਬਾਹਰਲੀ ਸਟੇਟਾਂ ਦਿਆ ਨੂੰ ਲੋਕਾਂ ਨੂੰ ਜ਼ਿਆਦਾ ਕੰਮ ਮਿਲਿਆ ਹੋਇਆ ਹੈ ਅਤੇ ਲੋਕਲ ਬੰਦਿਆਂ ਨੂੰ ਬਹੁਤ ਘੱਟ ਹੈ ਸਾਰੀਆਂ ਉੱਚ ਪੁਜੀਸ਼ਨਾਂ 'ਤੇ ਬਾਹਰਲੇ ਬੰਦੇ ਸਟੇਟਾਂ ਦੇ ਲੋਕ ਕੰਮ ਕਰਦੇ ਹਨ ਅਤੇ ਥੱਲੇ ਜਾਂ ਬਹੁਤ ਘੱਟ ਬੰਦਿਆਂ ਨੂੰ ਇੱਥੇ ਲੋਕਲਾਂ ਨੂੰ ਬਹੁਤ ਘੱਟ ਕੰਮ ਮਿਲਿਆ ਹੋਇਆ ਹੈ